ਧੀਮੀ ਕਾਰਗੁਜ਼ਾਰੀ ਤੁਹਾਡੇ ਲੈਪਟੋਪ ਦਾ ਬੂਟ ਹੋਣ ਦਾ ਜਾਂ ਕੰਮ ਵਿਚਕਾਰ ਲਟਕਣ ਲਈ ਹੌਲੀ ਹੋ ਸਕਦਾ ਹੈ ਇਸ ਪੂਰੀ ਹਾਰਡ ਡਰਾਈਵ ਜਾਂ ਬਹੁਤ ਸਾਰੀਆਂ ਬੈਕਗਰਾਊਂਡ ਪ੍ਰਤੀਕਿਰਿਆਵਾਂ ਕਾਰਨ ਹੋ ਸਕਦਾ ਹੈ ਵਾਈਫਾਈ ਡਿਸਕਨੈਕਟ ਤੁਹਾਡਾ ਲੈਪਟਾਪ ਅਕਸਰ ਵਾਈਫਾਈ ਤੋਂ ਡਿਸਕਨੈਕਟ ਹੋ ਸਕਦਾ ਹੈ ਅਤੇ ਇੱਕ ਕਮਜ਼ੋਰ ਸਿਗਨਲ ਇੱਕ ਪੁਰਾਣਾ ਵਾਈਰਲੇੈਸ ਅਡਾਪਟਰ ਜਾਂ ਤੁਹਾਡੇ ਰਾਉਂਡਰ ਰਾਊਟਰ ਦੇ ਕਾਰਨ ਹੋ ਸਕਦਾ ਹੈ ਸੁਰੱਖਿਆ ਚੇਤਾਵਨੀਆਂ ਜੇਕਰ ਤੁਸੀਂ ਬਰਾਊਜਿੰਗ ਕਰਦੇ ਸਮੇਂ ਲਗਾਤਾਰ ਸੁਰਕਸ਼ਿਤ ਚੇਤਾਵਨੀਆਂ ਦੇ ਦੇਖਦੇ ਹੋ ਤਾਂ ਤੁਹਾਡੇ ਕੰਪਿਊਟਰ ਦੀ ਬੜੀ ਗਲਤ ਹੋ ਸਕਦੀ ਹੈ ਡਰਾਉਣ ਵਾਲੀ ਬਿਪਿੰਗ ਜੇਕਰ ਤੁਹਾਡੇ ਲੈਪਟਾਪ ਨੂੰ ਚਾਲੂ ਕਰਨ ਤੋਂ ਡਰਾਉਣ ਵਾਲੀ ਬੀਪਿੰਗ ਆਵਾਜ਼ ਆਉਂਦੀ ਹੈ ਤਾਂ ਇੱਕ ਕੁੰਜੀ ਫਸ ਸਕਦੀ ਹੈ ਇਸ ਮੁੱਦੇ ਨੂੰ ਹੱਲ ਕਰਨ ਵਿੱਚ ਮਦਦ ਕਰਨ ਲਈ ਵਧੀਆ ਸੇਵਾਵਾਂ ਕੇਂਦਰ ਉਪਲਬਧ ਹਨ ਓਪਰੇਟਰ